ਛੱਬੀ ਮਾਰਚ ਦੋ ਹਜ਼ਾਰ ਤੇਈ ਗਿਆਰਾਂ ਅਪ੍ਰੈਲ ਦੋ ਹਜ਼ਾਰ ਤੇਈ ਪੰਦਰਾਂ ਮਈ ਦੋ ਹਜ਼ਾਰ ਤੇਈ ਇੱਕ ਅਗਸਤ ਦੋ ਹਜ਼ਾਰ ਤੇਈ ਛੱਬੀ ਨਵੰਬਰ ਦੋ ਹਜ਼ਾਰ ਤੇਈ